ਭਾਰਤ ਵਿੱਚ ਜਿਹੜਾ ਮੌਸਮ ਹੈ ਉਹ ਹਰੇਕ ਖੇਤਰ ਵਿੱਚ ਵੱਖਰਾ ਵੱਖਰਾ ਹੈ ਵੱਖਰੇ ਵੱਖਰੇ ਤਰੀਕੇ ਦਾ ਮੌਸਮ ਰਹਿੰਦਾ ਸਾਲ ਵਿੱਚ ਜਿੱਕਣਾ ਸਾਡਾ ਪੰਜਾਬ ਹੈ ਤਾਂ ਸਾਡੇ ਪੰਜਾਬ ਵਿੱਚ ਜਿਹੜਾ ਮੌਸਮ ਹੈ ਉੱਥੇ ਨਾ ਤਾਂ ਬਹੁਤ ਸਰਦੀ ਪੈਂਦੀ ਹੈ ਅਤੇ ਨਾ ਤਾਂ ਬਹੁਤ ਗਰਮੀ ਪੈਂਦੀ ਹੈ ਮੋਸਟਲੀ ਜਿਹੜੀ ਸਰਦੀ ਹੈ ਉਹ ਸਿਰਫ ਪੰਜਾਬ ਵਿੱਚ ਦਸੰਬਰ ਜਾਂ ਜਨਵਰੀ ਮਹੀਨੇ ਵਿੱਚ ਜ਼ਿਆਦਾ ਪੈਂਦੀ ਹੈ ਬਾਕੀ ਟਾਈਮ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਘੱਟ ਹੀ ਰਹਿੰਦੀ ਹੈ ਅਤੇ ਜਿਹੜੀ ਗਰਮੀ ਹੈ ਉਹ ਜੂਨ ਜੁਲਾਈ ਵਿੱਚ ਜ਼ਿਆਦਾ ਪੈਂਦੀ ਹੈ ਥੋੜ੍ਹੀ ਜਿਹੀ ਅਤੇ ਬਾਕੀ ਨਾਰਮਲ ਹੀ ਹੁੰਦਾ ਅਤੇ ਉਹ ਤੋਂ ਬਾਅਦ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਅਤੇ ਇੱਦਾਂ ਹੀ ਭਾਰਤ ਵਿੱਚ ਸਾਡਾ ਇੱਕ ਏਰੀਆ ਕੇਰਲਾ ਕੇਰਲਾ ਵਿੱਚ ਮੌਸਮ ਹੈ ਜਿਹੜਾ ਉਹ ਥੋੜ੍ਹਾ ਜਿਹਾ ਇਕੂਅਲ ਹੀ ਰਹਿੰਦਾ ਪਰ ਉੱਥੇ ਥੋੜ੍ਹੀ ਗਰਮੀ ਜ਼ਿਆਦਾ ਹੁੰਦੀ ਹੈ ਵੈਸੇ ਉੱਦਾਂ ਨੋਰਮਲ ਜਿਹਾ ਹੀ ਮੌਸਮ ਰਹਿੰਦਾ ਸਾਡਾ ਇੱਕ ਰਾਜ ਹੈ ਹਿਮਾਚਲ ਪ੍ਰਦੇਸ਼ ਅਤੇ ਉੱਥੇ ਠੰਡ ਥੋੜ੍ਹੀ ਜਿਹੀ ਜ਼ਿਆਦਾ ਰਹਿੰਦੀ ਹੈ ਅਤੇ ਗਰਮੀ ਬਹੁਤ ਘੱਟ ਪੈਂਦੀ ਹੈ ਜੰਮੂ ਵਿੱਚ ਥੋੜ੍ਹੀ ਬਰਫ ਜ਼ਿਆਦਾ ਪੈਣ ਕਰ ਕੇ ਉੱਥੇ ਸੂਰਜ ਵੀ ਬਹੁਤ ਘੱਟ ਚੜ੍ਹਦਾ ਅਤੇ ਇੱਦਾਂ ਹੀ ਸਾਡੇ ਭਾਰਤ ਵਿੱਚ ਵੱਖਰਾ ਵੱਖਰਾ ਮੌਸਮ ਹੈ ਹਰੇਕ ਸਟੇਟ ਦਾ ਵੱਖਰਾ ਵੱਖਰਾ ਮੌਸਮ